ਪ੍ਰਧਾਨ ਮੰਤਰੀ ਆਵਾਸ ਯੋਜਨਾ ਇੱਕ ਸਰਕਾਰੀ ਸਕੀਮ ਹੈ ਜੋ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਘਰ ਮੁਹੱਈਆ ਕਰਨ ਲਈ ਹੈ ਇਹ ਯੋਜਨਾ ਦੇ ਤਹਿਤ ਸਰਕਾਰ ਮੁਫ਼ਤ ਘਰਾਂ ਦੀ ਸਹਾਇਤਾ ਦਿੰਦੀ ਹੈ ਜਾਂ ਘਰ ਬਣਾਉਣ ਲਈ ਨੀਚੇ ਦਰਜੇ ਦੀਆਂ ਵਿਆਜ ਦਰਾਂ 'ਤੇ ਕਰੈਡਿਟ ਸਹਾਇਤਾ ਪ੍ਰਦਾਨ ਕਰਦੀ ਹੈ ਇਸ ਨਾਲ ਲੋਕਾਂ ਨੂੰ ਸਸਤੇ ਅਤੇ ਆਪਣੇ ਖੁਦ ਦੇ ਘਰ ਦੀ ਮਿ ਮਿਲਦੀ ਹੈ ਜਿਸ ਨਾਲ ਉਨ੍ਹਾਂ ਦੀ ਆਰਥਿਕ ਅਤੇ ਸੱਭਿਆਚਾਰਕ ਸੁੱਖ ਸਮਰਿੱਧੀ ਵਿੱਚ ਵਾਧਾ ਹੁੰਦਾ ਹੈ ਇਹਦਾ ਫਾਇਦਾ ਮੇਰੇ ਸਾਡੇ ਘਰ ਵਿੱਚ ਕੰਮ ਕਰਨ ਵਾਲੀ ਆਂਟੀ ਜੀ ਨੂੰ ਹੋਇਆ ਹੈ ਉਸ ਤੋਂ ਬਾਅਦ ਐੱਮ ਜੀ ਨਰੇਗਾ ਦੀ ਸਕੀਮ ਪ੍ਰਧਾਨ ਮੰਤਰੀ ਨੈਸ਼ਨਲ ਰੂਰਲ ਐਮਪਲੋਇਮੈਂਟ ਗਰੰਟੀ ਐਕਟ ਇੱਕ ਸਰਕਾਰੀ ਸਕੀਮ ਹੈ ਜੋ ਗ੍ਰਾਮੀਣ ਖੇਤਰ ਵਿੱਚ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਅਤੇ ਆਮਦਨ ਵਧਾਉਣ ਲਈ ਹੈ ਇਸ ਯੋਜਨਾ ਦੇ ਤਹਿਤ ਸਰਕਾਰ ਗ੍ਰਾਮੀਣ ਇਲਾਕਿਆਂ ਦੇ ਮਿਹਨਤਕਸ਼ ਲੋਕਾਂ ਨੂੰ ਸਾਲ ਵਿੱਚ ਘੱਟੋ ਘੱਟ ਸੌ ਦਿਨਾਂ ਲਈ ਕੰਮ ਮੁਹੱਈਆ ਕਰਦੀ ਹੈ ਇਸ ਸਕੀਮ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ ਲੋਕਾਂ ਨੂੰ ਸਹਿ ਸਹਿਤ ਰੁਜ਼ਗਾਰ ਮਿਲਦਾ ਹੈ ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਸੁਧਰਦੀ ਹੈ ਗ੍ਰਾਮੀਣ ਖੇਤਰ ਵਿੱਚ ਵਧੀਆ ਆਰਥਿਕ ਸੰਬੰਧਨ ਬਣਾਉਂਦੇ ਹਨ ਜੋ ਕਿ ਸਥਾਨਕ ਵਿਕਾਸ ਵਿੱਚ ਸਹਾਇਕ ਹੁੰਦਾ ਹੈ ਇਸ ਸਕੀਮ ਦੇ ਤਹਿਤ ਪ੍ਰਦਾਨ ਕੀਤੇ ਗਏ ਰੁਜ਼ਗਾਰ ਨਾਲ ਲੋਕਾਂ ਨੂੰ ਨਿਯਮਿਤ ਆਮਦਨ ਮਿਲਦੀ ਹੈ ਜੋ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਮੌਜੂਦਾ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ ਪਿੰਡਾਂ ਵਿੱਚ ਉਤਪਾਦਨ ਨਾਲ ਸਥਾਨਕ ਵਿਕਾਸ ਹੁੰਦਾ ਹੈ ਜਿਵੇਂ ਕਿ ਸੜਕਾਂ ਖੇਤਾਂ ਅਤੇ ਪਾਣੀ ਦੇ ਪ੍ਰਬੰਧ ਇਸ ਤਰ੍ਹਾਂ ਐੱਮ ਜੀ ਨਰੇਗਾ ਯੋਜਨਾ ਗ੍ਰਾਮੀਣ ਹਿੱਸੇ ਵਿੱਚ ਆਰਥਿਕ ਸੁਧਾਰ ਅਤੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਉਸ ਤੋਂ ਬਾਅਦ ਇੱਕ ਹੋਰ ਸਰਕਾਰੀ ਸਕੀਮ ਆਯੂਸ਼ਮਾਨ ਭਾਰਤ ਯੋਜਨਾ ਇੱਕ ਸਰਕਾਰੀ ਸਕੀਮ ਹੈ ਜੋ ਸਿਹਤ ਸੇਵਾਵਾਂ ਨੂੰ ਸਸਤਾ ਅਤੇ ਸਾਰਥਕ ਬਣਾਉਣ ਲਈ ਤਿਆਰ ਕੀਤੀ ਗਈ ਹੈ ਇਸ ਯੋਜਨਾ ਦੇ ਤਹਿਤ ਲੋੜਵੰਦ ਪਰਿਵਾਰਾਂ ਨੂੰ ਸਿਹਤ ਬੀਮਾ ਸਹਾਇਤਾ ਮ ਮੁਹੱਈਆ ਕੀਤੀ ਜਾਂਦੀ ਹੈ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਵੱਡੀ ਬੀਮਾ ਰਾਸ਼ੀ ਜਿਵੇਂ ਕਿ ਪੰਜ ਲੱਖ ਤੱਕ ਦੀ ਬੀਮਾ ਰਾਸ਼ੀ ਮਿਲਦੀ ਹੈ ਇਸ ਯੋਜਨਾ ਲਾਗੂ ਕਰਨ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਵਿੱਚ ਸੁਧਾਰ ਮਿਲਦਾ ਹੈ ਜਿਸ ਨਾਲ ਬਿਮਾਰੀਆਂ ਦਾ ਸਮੇਤ ਪੂਰਨ ਇਲਾਜ ਹੋ ਸਕਦਾ ਹੈ ਇਹ ਨੇ ਸਰਕਾਰੀ ਕੁਛ ਸਕੀਮਾਂ